ਹੈਲੋ ਹੈਲੋ ਹਾਂਜੀ ਟੂਰਿਸਟ ਏਜੰਟ ਸਿੰਘ ਬੋਲਦੇ ਆ ਜੀ ਹੋਰ ਵੀਰ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਆ ਬਸ ਤੁਹਾਡਾ ਜੀ ਜਤਿੰਦਰ ਸਿੰਘ ਨੇ ਨੰਬਰ ਦਿੱਤਾ ਸੀ ਕਹਿੰਦੇ ਵਧੀਆ ਬੰਦੇ ਨੇ ਅਸੀਂ ਘੁੰਮਣ ਜਾਣ ਦਾ ਕੋਈ ਪ੍ਰੋਗਰਾਮ ਬਣਾਉਂਦੇ ਆ ਪਹਾੜੀ ਏਰੀਏ 'ਚ ਸਾਨੂੰ ਉਹਦੇ ਬਾਰੇ ਦੱਸੋ ਕੀ ਚਾਰਜ ਕਿਹੜਾ ਥੋਂ ਸਾਨੂੰ ਘੁੰਮਾ ਕੇ ਲਿਆਓਂਗੇ ਕਿੱਥੇ ਕਿੱਥੇ ਹਾਂ ਜੀ ਹਾਂ ਜੀ ਪਰਿਵਾਰ ਸਮੇਤ ਪੰਜ ਜੀਅ ਹਾਂ ਅਸੀਂ ਮੀਆਂ ਬੀਵੀ ਅਤੇ ਬੱਚੇ ਨੇ ਹਾਂਜੀ ਹਾਂ ਪੰਜ ਜਾਣੇ ਅੱਛਾ ਜੀ ਉਹਦੀ ਕੋਈ ਖਾਸੀਅਤ ਠੀਕ ਹੈ ਜੀ ਹਾਂ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ

ਠੀਕ ਹੈ ਜੀ ਬਸ ਪੰਜ ਪੰਜ ਪੰਜ ਜੀਅ ਆ ਅਸੀਂ ਇੱਕ

ਠੀਕ ਹੈ ਜੀ ਅੱਛਾ ਇਹਦੇ ਬਾਰੇ ਫਿਰ ਗੱਡੀ ਕੋਈ ਟੈਕਸੀ ਸਾਨੂੰ ਕਿਹੜੀ ਗੱਡੀ ਭੇਜੋਂਗੇ ਗੱਡੀ ਜਿਹੜੀ ਸਰਾਕਪੀਓ ਸਭ ਦਾ ਜਾਂ ਬੱਚਿਆਂ ਵਾਸਤੇ ਵੀ ਠੀਕ ਰਹੇ ਜਿਹੜੀ ਫਿਰ ਵੀ ਰੇਟ ਸਾਨੂੰ ਠੀਕ ਸਾਨੂੰ ਰੇਟ ਤਾਂ ਅੰਦਾਜ਼ਾ ਦੱਸਦੋ ਜੀ ਅੱਛਾ ਜੀ ਉੱਕਾ ਪੂੱਕਾ ਉੱਕਾ ਪੂੱਕਾ ਅਸੀਂ ਪੰਜ ਦਿਨ ਦਾ ਪ੍ਰੋਗਰਾਮ ਰੱਖੋ ਜੀ ਠੀਕ ਠੀਕ ਆ ਚਲੋ ਜੀ ਠੀਕ ਹੈ ਚਲੋ ਜੀ ਅਸੀਂ ਫਿਰ ਸਲਾਹ ਕਰਕੇ ਕੱਲ੍ਹ ਨੂੰ ਆਪਾਂ ਮਿਲਦੇ ਆ ਕੱਲ੍ਹ ਨੂੰ ਤੁਹਾਡੇ ਦਫਤਰ ਆਵਾਂਗੇ ਠੀਕ ਠੀਕ ਹੈ ਜੀ ਤੁਸੀਂ ਵਟਸਐਪ ਕਰਦੋ ਹਾਂ ਚੰਗਾ ਇਸੇ ਨੰਬਰ 'ਤੇ ਚੱਲਦਾ ਜੀ ਠੀਕ ਚੰਗਾ ਧੰਨਵਾਦ ਜੀ ਧੰਨਵਾਦ ਤੁਹਾਡਾ ਓਕੇ ਜੀ ਥੈਂਕ ਯੂ ਥੈਂਕ ਯੂ